ਸਾਡਾ ਧਰਮ ਆ ਜਿਹੜਾ ਇਹ ਜਿਹੜਾ ਸਕੂਲ ਦੇ ਪਾਠਕ੍ਰਮ ਦਾ ਹਿੱਸਾ ਹੈਗਾ ਇਹ ਜਿਹੜਾ ਧਰਮ ਆ ਇਹਦੇ ਨਾਲ ਸਾਨੂੰ ਸਮਾਜ ਦੇ ਵਿੱਚ ਮਤਲਬ ਵਧੀਆ ਸਿੱਖਿਆ ਮਿਲਦੀ ਆ ਵੀ ਕਿਸ ਤਰ੍ਹਾਂ ਸੱਚਾ ਸੁੱਚਾ ਜੀਵਨ ਬਤੀਤ ਕਰਨਾ ਝੂਠ ਨਫਰਤ ਤੋਂ ਪਰਾਂ ਹਟ ਕੇ ਆਪਣਾ ਜੀਵਨ ਬਤੀਤ ਕਰੋ ਸਾਡਾ ਜਿਹੜਾ ਹੈਗਾ ਧਰਮ ਆ ਇਹ ਮਤਲਬ ਵਧੀਆ ਲੀਹ 'ਤੇ ਹੀ ਅਗਲੇ ਨੂੰ ਹਰ ਇੱਕ ਨੂੰ ਲੈ ਕੇ ਜਾਂਦਾ ਇਹ ਇਸ ਤਰ੍ਹਾਂ ਦਾ ਧਰਮ ਆ ਬਾਕੀ ਮ ਇਹਨਾਂ ਇਸ ਧਰਮ ਨੇ ਸਾਡਾ ਜ਼ਿੰਦਗੀ ਦਾ ਮਤਲਬ ਨਜ਼ਰੀਆ ਹੀ ਬਦਲਤਾ